ਸਾਈਕਲ ਚਲਾਉਂਦੇ ਸਮੇਂ ਹਮੇਸ਼ਾ ਹੈਲਮਟ ਪਾਓ ਸਿਗਨਲ ਲਾਈਟਸ ਦੇ ਨਿਯਮ ਅਨੁਸਾਰ ਜਿਹੜਾ ਸਾਈਕਲ ਚਲਾਉਣਾ ਚਾਹੀਦਾ ਸਾਈ ਸੜਕ 'ਤੇ ਟਰੈਫਿਕ ਨਿਯਮਾਂ ਦਾ ਵੀ ਪਾਲਣ ਕਰਕੇ ਸਾਈਕਲ ਚਲਾਉਣਾ ਚਾਹੀਦਾ ਸਾਈਕਲ ਜਿਹੜਾ ਵਾ ਆਰਾਮ ਨਾਲ ਚਲਾਉਣਾ ਚਾਹੀਦਾ ਅਤੇ ਹਮੇਸ਼ਾ ਆਪਣੇ ਹੱਥ ਚਲਾਉਣਾ ਚਾਹੀਦਾ ਸਾਈਕਲ ਦੀ ਜਿਹੜੀ ਆ ਹਮੇਸ਼ਾ ਜਾਂਚ ਕਰਾਉਂਦੇ ਰਹਿਣਾ ਚਾਹੀਦਾ ਹੈ ਸਾਈਕਲ ਦੀ ਬ੍ਰੇਕ ਵੀ ਚੈੱਕ ਕਰੋ ਅਤੇ ਟਾਇਰਾਂ ਦੀ ਹਾਲਤ ਨੂੰ ਵੀ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਲੰਬੀ ਯਾਤਰਾ ਲਈ ਸਾਨੂੰ ਜਿਹੜਾ ਪ੍ਰੋਟੀਨ ਪਾਣੀ ਅਤੇ ਊਰਜਾ ਦਾ ਵੀ ਧਿਆਨ ਰੱਖਣਾ ਚਾਹੀਦਾ ਹੋਰ ਜਿਹੜੇ ਯਾਤਰਾ ਦੇ ਦੌਰਾਨ ਜਿਹੜੇ ਆ ਸਾਨੂੰ ਹੇਠ ਲਿਖੇ ਦਸਤਾਵੇਜ ਨਾਲ ਲਿਆਉਣੇ ਚਾਹੀਦੇ ਆ ਜਿਵੇਂ ਇੱਕ ਸੁਰੱਖਿਅਤ ਲੈ ਲਈ ਹੈਲਮਟ ਇਹ ਕਾਨੂੰਨ ਦੇ ਅਨੁਸਾਰ ਤੁਹਾਡੀ ਸੁਰੱਖਿਆ ਲਈ ਲਾਜ਼ਮੀ ਆ ਠੀਕ ਹੈ ਹੋਰ ਲਾਈਟਸ ਦੇ ਬੈਕਸਾਰ ਇਹ ਵੀ ਜਿਹੜਾ ਵਾ ਇਹਦੀ ਵਰਤੋਂ ਕਰਨੀ ਚਾਹੀਦੀ ਆ ਹੋਰ ਯਾਤਰਾ ਦੌਰਾਨ ਜਿਹੜੀ ਹੈ ਦਰਸ਼ਨ ਮੈਪ ਨੂੰ ਵੀ ਵੇਖਣਾ ਚਾਹੀਦਾ ਅਤੇ ਨਜ਼ਦੀਕੀ ਜਿਹੜੀ ਥਾਂ ਦੀ ਇਹਦੇ ਨਾਲ ਜਾਣਕਾਰੀ ਲਿਆਓ ਹੋਰ ਸਾਈਕਲ ਦੀ ਰਿਪੇਅਰ ਅਤੇ ਸੰਭਾਲ ਲਈ ਵੀ ਕੁਛ ਟੂਲ ਜਿਹੜੇ ਨਾਲ ਲੈ ਕੇ ਆਉਣੇ ਚਾਹੀਦੇ ਹੈ ਸਾਈਕਲ ਦੀ ਯਾਤਰਾ ਨੂੰ ਇਨਜੋਏ ਕਰਨ ਲਈ ਮੋਬਾਈਲ ਫੋਨ ਅਤੇ ਈਮ ਈਮੇਲ ਦੇ ਸੰਪਰਕ ਨੰਬਰ ਨਾਲ ਲਿਆਓ ਧੰਨਵਾਦ